ਛੋਟੇ ਕਾਰੋਬਾਰ ਭਾਰਤ ਭਾਰਤ ਵਿੱਚ ਜਿਹੜੇ ਸਾਡੇ ਸਾਡੇ ਪੰਜਾਬ ਇਲਾਕੇ ਦੇ ਵਿੱਚ ਹੈਗੇ ਆ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਲੁਧਿਆਣੇ ਦੇ ਵਿੱਚ ਜਿਵੇਂ ਮੈਚੈਸਟਰ ਔਫ ਇੰਡੀਆ ਲੁਧਿਆਣਾ ਨੂੰ ਕਿਹਾ ਜਾ ਸਕਦਾ ਤਾਂ ਵੂਲਨ ਕੱਪੜੇ ਜਿਹੜੇ ਉਨੀ ਕੱਪੜੇ ਨੇ ਉਹਨਾਂ ਦਾ ਵਪਾਰ ਕੀਤਾ ਜਾ ਸਕਦਾ ਹੈ ਸਮਾਲ ਸਕੇਲ ਇੰਡਸਟਰੀ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਅਸੀਂ ਇੱਕ ਤੋਂ ਦੋ ਮਸ਼ੀਨਾਂ ਲਗਾਉਂਦੇ ਹਾਂ ਇਹਦੇ ਲਈ ਕੀ ਹੈ ਕਿ ਆਪਾਂ ਨੂੰ ਅਰਜੈਂਟ ਪੈਸੇ ਦੀ ਲੋੜ ਪੈਂਦੀ ਦੋ ਮਸ਼ੀਨਾਂ ਲਗਾਉਣੀਆਂ ਤਾਂ ਉਹਦੇ ਲਈ ਸਰਕਾਰਾਂ ਵੀ ਸਬਸਿਡੀਸ ਦਿੰਦੀਆਂ ਲੋਨਸ ਵੀ ਦਿੰਦੀਆਂ ਨੇ ਅੱਗੇ ਵਧਣ ਦੇ ਲਈ ਮੋਲ ਸਕੇਲ ਇੰਡਸਟਰੀ ਲਈ ਬਹੁਤ ਜ਼ਿਆਦਾ ਇਸ ਟਾਈਮ ਜਿਹੜੀ ਸਾਡੀ ਸਰਕਾਰਾਂ ਨੇ ਉਹ ਬਹੁਤ ਮਦਦ ਕਰ ਰਹੀਆਂ ਨੇ ਅੱਗੇ ਵਧਣ ਦੇ ਵਿੱਚ ਹੋਰ ਕੀ ਹੈ ਸਾਨੂੰ ਉਹਦੇ 'ਚ ਰੋ ਮਟੀਰੀਅਲ ਚਾਹੀਦਾ ਹੁੰਦਾ ਜਿਹੜਾ ਧਾਗਾ ਹੁੰਦਾ ਉਹਦੇ 'ਚ ਵੀ ਮਦਦ ਮਿਲਦੀ ਹੈ ਸਾਨੂੰ ਵਪਾਰੀਆਂ ਵੱਲੋਂ ਵੀ ਮਿਲਦੀ ਸਰਕਾਰਾਂ ਵੱਲੋਂ ਵੀ ਮਿਲਦੀ ਹੈ ਸਮੋਲ ਸਕੇਲ ਇੰਡਸਟਰੀ ਇਸ ਤਰ੍ਹਾਂ ਨਾਲ ਅੱਗੇ ਵਧਾਈ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ